ਮੈਂ ਕੁਝ ਸਮੇਂ ਪਹਿਲਾਂ ਮਿੰਤਰਾਂ ਐਪ ਤੋਂ ਬਹੁਤ ਸਾਰੇ ਈਅਰਿੰਗਸ ਮੰਗਵਾਏ ਸੀ ਜਿਨ੍ਹਾਂ ਦੀ ਕੁਆਲਿਟੀ ਬਹੁਤ ਹੀ ਘਟੀਆ ਨਿਕਲੀ ਮੈਂ ਇੱਕ ਮੈਰਿਜ਼ 'ਤੇ ਈਅਰਿੰਗਸ ਨੂੰ ਵੇਅਰ ਕਰਕੇ ਗਈ ਅਤੇ ਉੱਥੇ ਉ ਸੱਤਿਆਨਾਸ ਕਰਤਾ ਈਅਰਿੰਗਸ ਨੇ ਅਤੇ ਵਾਰ ਵਾਰ ਫ਼ਿਸਲੀ ਗਏ ਅਤੇ ਵਿਆਹ ਤੋਂ ਵਾਪਸ ਆਉਂਦੇ ਹੋਏ ਮੇਰਾ ਇੱਕ ਈਅਰਿੰਗ ਉੱਥੇ ਗਿਰ ਵੀ ਗਿਆ ਸੋ ਪਲੀਜ਼ ਤੁਸੀਂ ਇਨ੍ਹਾਂ ਨੂੰ ਟਰਾਏ ਕਰਨ ਦੀ ਨਾ ਸੋਚੀਉ ਕਿਉਂਕਿ ਬਹੁਤ ਹੀ ਘਟੀਆ ਕੁਆਲਿਟੀ ਦੇ ਈਅਰਿੰਗਸ ਸੀ